ਅੱਜ ਕੱਲ੍ਹ ਦੇ ਆਧੁਨਿਕ ਯੁੱਗ ਵਿੱਚ ਸਾਡੇ ਸ਼ਹਿਰ ਪਟਿਆਲਾ ਦੇ ਵਿੱਚ ਬਹੁਤ ਸਾਰੀਆਂ ਫੋਟੋਗ੍ਰਾਫੀ ਗੈਲਰੀ ਬਣੀਆਂ ਹੋਈਆਂ ਹਨ ਜਿੱਥੇ ਕਿ ਮੈਂ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਜਾਂਦਾ ਹਾਂ ਕਿਉਂਕਿ ਉੱਥੇ ਬਹੁਤ ਵੱਡੇ ਵੱਡੇ ਫੋਟੋਗ੍ਰਾਫਰਜ਼ ਦੁਆਰਾ ਖਿੱਚੀਆਂ ਗਈਆਂ ਫੋਟੋਆਂ ਲੱਗੀਆਂ ਹੋਈਆਂ ਹਨ ਜਿਹੜੀਆਂ ਕਿ ਮੈਨੂੰ ਬਹੁਤ ਹੀ ਜ਼ਿਆਦਾ ਪ੍ਰੇਰਿਤ ਕਰਦੀਆਂ ਹਨ ਇਸ ਕਰੀਅਰ ਦੇ ਨਾਲ ਜੁੜਨ ਦੇ ਲਈ ਜਿਸ ਕਰਕੇ ਮੈਂ ਵੱਖ ਵੱਖ ਥਾਵਾਂ ਉੱਤੇ ਜਾਂਦਾ ਹਾਂ ਅਤੇ ਬਹੁਤ ਸਾਰੀਆਂ ਫੋਟੋ ਖਿੱਚਦਾ ਹਾਂ ਜਿਨ੍ਹਾਂ ਨੂੰ ਕਿ ਮੈਂ ਉਸ ਮਿਊਜ਼ੀਅਮ ਗੈਲਰੀ ਦੇ ਵਿੱਚ ਦੇ ਕੇ ਆ ਸਕਾਂ ਤਾਂ ਕਿ ਲੋਕ ਉਹਨਾਂ ਨੂੰ ਦੇਖਣ ਅਤੇ ਖੁਸ਼ ਹੋਣ ਧੰਨਵਾਦ